ਹੈਲੋ ਹਾਂਜੀ ਜੀ ਹਾਂਜੀ ਕੌਣ ਬੋਲ ਰਿਹਾ ਜੀ ਹਾਂਜੀ ਹਾਂਜੀ ਮੈਨੂੰ ਆਪਕਾ ਨਾਮ ਜਾਨ ਸਕਤਾ ਹੂ ਜੀ ਅ ਦ ਤੁਹਾਡਾ ਨਾਮ ਜਾਣ ਸਕਦਾ ਆ ਹਾਂਜੀ ਜੀ ਹਾਂਜੀ ਜੀ ਜੀ ਦਿਨੇਸ਼ ਜੀ ਹਾਂਜੀ ਜੀ ਅਤੇ ਤੁਹਾਡਾ ਹਾਈਟ ਅਤੇ ਵੇਟ ਕਿੰਨਾ ਹੈ ਜੀ

ਜੀ ਜੀ ਜੀ ਠੀਕ ਹੈ ਜੀ ਸਰ ਕੀ ਚੈਲੇਂਜ ਆ ਰਿਹਾ ਤੁਹਾਨੂੰ ਹੁਣ ਹਾਂਜੀ ਜੀ ਜੀ ਜੀ ਅਤੇ ਤੁਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਕੀ ਕੀ ਖਾ ਰਹੇ ਹੋ ਜੀ ਜੀ ਹਾਂਜੀ ਅੱਛਾ ਜੀ ਅਤੇ ਤੁਸੀਂ ਪਾਣੀ ਕਿੰਨਾ ਡੇਲੀ ਪੀ ਰਹੇ ਹੋ ਹਾਂ ਸਰ ਦੇਖੋ ਤੁਹਾਡੇ ਹਾਈਟ ਅਤੇ ਵੇਟ ਦੇ ਅਕੋਰਡਿੰਗਲੀ ਤੁਹਾਨੂੰ ਘੱਟੋ ਘੱਟ ਚਾਰ ਲੀਟਰ ਪਾਣੀ ਪੀਣਾ ਚਾਹੀਦਾ ਆ ਸਾਨੂੰ ਵੀ ਸਾਡਾ ਜਿੱਦਾਂ ਆਪਾਂ ਸਬਜ਼ੀ ਬਣਾਉਂਦੇ ਹਾਂ ਸਬਜ਼ੀ ਦੇ ਵਿੱਚ ਉਹਨੂੰ ਪਤਲਾ ਕਰਨ ਲਈ ਆਪਾਂ ਵਿੱਚ ਪਾਣੀ ਪਾਉਂਦੇ ਹਾਂ ਕਿਉਂਕਿ ਸਾਡੀ ਗ੍ਰੇਵੀ ਜਿਹੜੀ ਆ ਵਧੀਆ ਬਣ ਜਾਵੇ ਹੁਣ ਇੱਦਾਂ ਹੀ ਬੌਡੀ ਹੈ ਸਾਡੀ ਜਦੋਂ ਅਸੀਂ ਜ਼ਿਆਦਾ ਚੀਜ਼ਾਂ ਖਾਂਦੇ ਹਾਂ ਘੱਟ ਪਾਣੀ ਪੀਂਦੇ ਹਾਂ ਅਤੇ ਉਹ ਅੰਦਰ ਮ ਮਾਦਾ ਜਿਹਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਪਾਣੀ ਪ੍ਰੋਪਰ ਪੀਵਾਂਗੇ ਤੁਹਾਡੀ ਬੌਡੀ 'ਚ ਜਿੰਨੀ ਵੇਸਟੇਜ ਹੈਗੀ ਹੈ ਉਹ ਸਾਡੀ ਜਿਹੜੀ ਹੈ ਬਾਹਰ ਨਿਕਲਣੀ ਸ਼ੁਰੂ ਹੋ ਜਾਵੇਗੀ ਈਜ਼ੀਲੀ ਬਾਕੀ ਕੋਈ ਗੱਲ ਨਹੀਂ ਤੁਸੀਂ ਇਵਨਿੰਗ 'ਚ ਮੇਰੇ ਕਲੀਨਿਕ ਆ ਜਾਓ ਅਤੇ ਅਸੀਂ ਆਰਾਮ ਨਾਲ ਬੈਠ ਕੇ ਬਾਕੀ ਚੈੱਕ ਕਰ ਲਵਾਂਗੇ ਕੀ ਦਿੱਕਤ ਆ ਰਹੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਜੀ ਸ਼ੋਅਰ ਜੀ ਸ਼ੋਅਰ ਠੀਕ ਹੈ ਜੀ ਓਕੇ ਜੀ